ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ ਪਰ ਹੋਕੀ ਫੁੱਟਬੋਲ ਕ੍ਰਿਕਟ ਕਬੱਡੀ ਅਤੇ ਐਥਲੀਟ ਨੂੰ ਬਹੁਤ ਹੀ ਜ਼ਿਆਦਾ ਮਾਨਤਾ ਦਿੱਤੀ ਜਾ ਰਹੀ ਹੈ ਅੱਜ ਦੇ ਸਮੇਂ ਵਿੱਚ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਰੇਕ ਗੇਮ ਦੀ ਜੋਨ ਲੈਵਲ ਤੋਂ ਕੋਮਪੀਟੀਸ਼ਨ ਹੁੰਦੇ ਹਨ ਜਦੋਂ ਕੋਈ ਟੀਮ ਇਸ ਵਿੱਚ ਹਿੱਸਾ ਲੈ ਕੇ ਮਾਨਤਾ ਪ੍ਰਾਪਤ ਕਰਦੀ ਹੈ ਅਤੇ ਉਸਨੂੰ ਡਿਸਟਿਕ ਲੈਵਲ 'ਤੇ ਭੇਜਿਆ ਜਾਂਦਾ ਹੈ ਡਿਸਟਿਕ ਦੇ ਵਿੱਚ ਸਾਰੀ ਡਿਸਟਿਕ ਦੇ ਪਲੇਅਰ ਅਤੇ ਸਾਰੇ ਡਿਸਟਿਕ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਹਨ ਅਤੇ ਡਿਸਟਿਕ ਪੱਧਰ 'ਤੇ ਸਾਰੇ ਮੈਚ ਹੁੰਦੇ ਹਨ ਜਦੋਂ ਕੋਈ ਮੈਚ ਜਿੱਤਦਾ ਹੈ ਡਿਸਟਿਕ ਦੇ ਵਿੱਚ ਤਾਂ ਉਸ ਨੂੰ ਉੱਤੇ ਵਾਲੇ ਲੈਵਲ ਦੇ ਵਿੱਚ ਭੇਜਿਆ ਜਾਂਦਾ ਹੈ ਉਸਨੂੰ ਸਟੇਟ ਲੈਵਲ ਦੇ ਵਿੱਚ ਖੇਡਾਇਆ ਜਾਂਦਾ ਹੈ ਪਰ ਜਦੋਂ ਕੋਈ ਟੀਮ ਸਟੇਟ ਲੈਵਲ ਦੇ ਵਿੱਚ ਵਿਨਰ ਆਉਂਦੀ ਹੈ ਜਦੋਂ ਉੱਥੋਂ ਮਾਨਤਾ ਪ੍ਰਾਪਤ ਕਰਦੀ ਹੈ ਅਤੇ ਜਿੱਤਦੀ ਹੈ ਉਸਨੂੰ ਨੈਸ਼ਨਲ ਲੈਵਲ ਦੇ ਵਿੱਚ ਵਧੀਆ ਪਲੇਅਰਾਂ ਨੂੰ ਚੁਣਿਆ ਜਾਂਦਾ ਹੈ ਇਹ ਮੰਨ ਲਓ ਕਿ ਹਾਕੀ ਫੁੱਟਬੋਲ ਕੋਈ ਵੀ ਗੇਮ ਹੋਵੇ ਉਸ ਦੇ ਵਿੱਚ ਵਧੀਆ ਪਲੇਅਰਾਂ ਨੂੰ ਚੁਣ ਕੇ ਨੈਸ਼ਨਲ ਦੇ ਵਿੱਚ ਪਾਇਆ ਜਾਂਦਾ ਹੈ ਜਦੋਂ ਨੈਸ਼ਨਲ ਦੇ ਵਿੱਚ ਇਸ ਗੇਮ ਦੇ ਦੇ ਮੁਕਾਬਲੇ ਹੁੰਦੇ ਹਨ ਤਾਂ ਉਸਦੇ ਵਿੱਚ ਹਰੇਕ ਵਿਅਕਤੀ ਨੂੰ ਇੰਨਾ ਜ਼ਿਆਦਾ ਪਰਫੈਕਟ ਕੀਤਾ ਜਾਂਦਾ ਹੈ ਕਿ ਉਹ ਬਹੁਤ ਹੀ ਵਧੀਆ ਪ੍ਰਦਰਸ਼ਨ ਕਰੇ ਅਤੇ ਬਹੁਤ ਹੀ ਵਧੀਆ ਖੇਡੇ ਅਤੇ ਇਸ ਨੂੰ ਨੈਸ਼ਨਲ ਦੇ ਬਾਅਦ ਉਸ ਨੂੰ ਇੰਡੀਆ ਟੀਮ ਜਾਂ ਵਧੀਆ ਟੀਮ ਦੇ ਵਿੱਚ ਸਿਲੈਕਟ ਕੀਤਾ ਜਾਂਦਾ ਹੈ ਵਧੀਆ ਕੰਪਨੀ ਦੇ ਵੱਲੋਂ ਖਿਡਾਇਆ ਜਾਂਦਾ ਹੈ ਤਾਂ ਜੋ ਉਸ ਕੰਪਨੀ ਦਾ ਨਾਮ ਉੱਚਾ ਕਰੇ ਅਤੇ ਇਹ ਇਸ ਤੋਂ ਇਲਾਵਾ ਕੁਝ ਪਿੰਡਾਂ ਦੇ ਵਿੱਚ ਵੀ ਮੈਚ ਕਰਵਾਏ ਜਾਂਦੇ ਹਨ ਜੋ ਕਿ ਪੰਚਾਇਤਾਂ ਦੁਆਰਾ ਕਰਵਾਏ ਜਾਂਦੇ ਹਨ ਪੰਚਾਇਤਾਂ ਦੁਆਰਾ ਪੈਸਾ ਇਕੱਠਾ ਕਰਕੇ ਜੋ ਵੀ ਪੰਜ ਸਾਲਾਂ ਦੀ ਗ੍ਰਾਂਟ ਹੁੰਦੀ ਹੈ ਉਸ ਨੂੰ ਖੇਡ ਦੇ ਪ੍ਰਦਰਸ਼ਨ ਵੱਲ ਲਾਇਆ ਜਾ ਜਾਂਦਾ ਹੈ ਤਾਂ ਜੋ ਬੱਚਿਆਂ ਦਾ ਹੋਰ ਵੀ ਜ਼ਿਆਦਾ ਮਨੋਰੰਜਨ ਦਾ ਵਾਧਾ ਹੋਵੇ ਤਾਂ ਜੋ ਬੱਚੇ ਹੋਰ ਵੀ ਜ਼ਿਆਦਾ ਅਤੇ ਹਿੱਸਾ ਲੈਣ ਨਸ਼ਿਆਂ ਤੋਂ ਮੁਕਤ ਹੋਣ ਅਤੇ ਆਪਣੀ ਗੇਮ ਵੱਲ ਧਿਆਨ ਦੇਣ ਅਤੇ ਪੰਚਾਇਤ ਦੇ ਵਿੱਚ ਬਹੁਤ ਹੀ ਸਾਰੇ ਮੰਨ ਲਓ ਕਿ ਡਿਪਟੀ ਕਮਿਸ਼ਨਰ ਅਤੇ ਹੋਰ ਵੀ ਐਮ ਐਲ ਏ ਆ ਕੇ ਯੋਗਦਾਨ ਪਾਉਂਦੇ ਹਨ ਅਤੇ ਗੇਮ ਦਾ ਹਿੱਸਾ ਵਧਾਉਂਦੇ ਹਨ ਅਤੇ ਉਹਨਾਂ ਨੂੰ ਉਤੇਜਿਤ ਕਰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਖੇਡੋ ਇਸ ਨਾਲ ਬੱਚੇ ਬਹੁਤ ਹੀ ਜ਼ਿਆਦਾ ਇਸ ਗੇਮ ਗੇਮਾਂ ਨੂੰ ਜੁੜ ਰਹੇ ਹਨ ਅਤੇ ਕੋਮਪੀਟੀਸ਼ਨ ਬਹੁਤ ਹੀ ਜ਼ਿਆਦਾ ਵੱਧ ਰਿਹਾ ਹੈ ਅਤੇ ਲਾਸਟ ਮਹੀਨੇ ਅਸੀਂ ਆਪਦੇ ਪਿੰਡ ਵਿੱਚ ਟੂਰਨਾਮੈਂਟ ਕਰਵਾਇਆ ਸੀ ਉੱਥੇ ਅਸੀਂ ਐਮ ਐਲ ਏ ਅਤੇ ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਡਿਸਟਿਕ ਕਮਿਸ਼ਨਰ ਨੂੰ ਵੀ ਬੁਲਾਇਆ ਸੀ ਅਤੇ ਉਨ੍ਹਾਂ ਨੇ ਬਹੁਤ ਜ਼ਿਆਦਾ ਇਕੱਠ ਦੇਖ ਕੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਖੁਸ਼ ਹੋਏ ਅਤੇ ਉਹਨਾਂ ਨੇ ਇੱਕ ਵੱਡੇ ਪੱਧਰ 'ਤੇ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਲਿੱਤਾ ਹੈ ਇਸ ਵਿੱਚ ਹੋਕੀ ਫੁੱਟਬਾਲ ਬੋਲੀਵੋਲ ਅਤੇ ਪੰਜਾਬ ਦੀਆਂ ਜਿੰਨੀਆਂ ਵੀ ਵੱਡੀਆਂ ਗੇਮਾਂ ਹਨ ਉਹਨਾਂ ਨੂੰ ਵਿੱਚ ਬੱਚਿਆਂ ਨੂੰ ਯੋਗਦਾਨ ਪਾਉਣ ਲਈ ਉਤੇਜਿਤ ਕੀਤਾ ਹੈ ਧੰਨਵਾਦ